ਮੈਨੇ ਆਮ ਤੌਰ 'ਤੇ ਤਾਂ ਕਦੇ ਕੋਈ ਮੂਰਤੀ ਨਹੀਂ ਬਣਾਈ ਪਰ ਇੱਕ ਵਾਰ ਦਿਵਾਲੀ ਦੇ ਮੌਕੇ 'ਤੇ ਅਸੀਂ ਗਲੀ ਦੇ ਬੱਚਿਆਂ ਨੇ ਮਿਲ ਕੇ ਸ਼੍ਰੀ ਰਾਮ ਜੀ ਦੀ ਮੂਰਤੀ ਬਣਾਈ ਸੀ ਜੋ ਕਿ ਅਸੀਂ ਪੂਰੀ ਤਰ੍ਹਾਂ ਮਿੱਟੀ ਤੋਂ ਹੀ ਬਣਾਈ ਸੀ ਅਤੇ ਫਿਰ ਉਸ 'ਤੇ ਰੰਗ ਵੀ ਕੀਤਾ ਸੀ ਇਸ ਤੋਂ ਇਲਾਵਾ ਅਸੀਂ ਉਸ ਨੂੰ ਚੰਗੀ ਤਰ੍ਹਾਂ ਸਜਾਇਆ ਸੀ ਜਿਸ ਲਈ ਅਸੀਂ ਬਹੁਤ ਸਾਰੇ ਕੱਪੜਿਆਂ ਅਤੇ ਗਹਿਣਿਆਂ ਦਾ ਇਸਤੇਮਾਲ ਕੀਤਾ ਸੀ ਮੇਰਾ ਇਹ ਅਨੁਭਵ ਬਹੁਤ ਜ਼ਿਆਦਾ ਵਧੀਆ ਰਿਹਾ ਅਸੀਂ ਇਸ ਵਿੱਚ ਬਹੁਤ ਆਨੰਦ ਹਾਸਿਲ ਕੀਤਾ ਅਸੀਂ ਸਭ ਨੇ ਮਿਲ ਕੇ ਬਹੁਤ ਮਜ਼ੇ ਕੀਤੇ ਅਤੇ ਮਜ਼ੇ ਮਜ਼ੇ ਨਾਲ ਹੀ ਇਹ ਮੂਰਤੀ ਬਣਾਈ ਦਿਵਾਲੀ ਦਾ ਤਿਉਹਾਰ ਸਾਡੇ ਲਈ ਬਹੁਤ ਮੁੱਖ ਹੁੰਦਾ ਹੈ ਅਤੇ ਇਹ ਸ਼੍ਰੀ ਰਾਮ ਜੀ ਦੇ ਵਾਪਸ ਆਉਣ ਦਾ ਦਿਨ ਹੁੰਦਾ ਹੈ ਇਸ ਲਈ ਅਸੀਂ ਇਸ ਦਿਨ ਬਹੁਤ ਉਤਸ਼ਾਹਿਤ ਸੀ ਅਤੇ ਫਿਰ ਅਸੀਂ ਉਸ ਮੂਰਤੀ ਨੂੰ ਸ਼ਾਮ ਨੂੰ ਪੂਜਾ ਵੇਲੇ ਮੰਦਰ ਵਿੱਚ ਰੱਖ ਕੇ ਪੂਜਾ ਕੀਤੀ ਅਤੇ ਆਰਤੀ ਗਾਈ ਸਾਨੂੰ ਬਹੁਤ ਖੁਸ਼ੀ ਸੀ ਕਿ ਅਸੀਂ ਖੁਦ ਇਹ ਮੂਰਤੀ ਬਣਾਈ ਹੈ ਮੈਨੂੰ ਇਸ ਤੋਂ ਇਸ ਦਿਨ ਤੋਂ ਬਾਅਦ ਬਹੁਤ ਵਧੀਆ ਲੱਗਿਆ ਅਤੇ ਮੈਂ ਫਿਰ ਹੋਰ ਮੂਰਤੀਆਂ ਵੀ ਬਣਾਈਆਂ